ਮੈਂ ਇਸ ਟੀ ਵੀ ਸ਼ੋਅ ਬਾਰੇ ਕੁਛ ਨਹੀਂ ਜਾਣਦਾ ਹਾਂ ਬਸ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਇਸ ਬਾਰੇ ਥੋੜ੍ਹਾ ਬਹੁਤ ਸੁਣਿਆ ਹੈ ਬਟ ਮੈਨੂੰ ਇਸ ਬਾਰੇ ਕੁਛ ਨਹੀਂ ਪਤਾ